ਸਾਡੇ ਪਿੰਡ ਦੇ ਵਿੱਚ ਇੱਕ ਤਾਂ ਕਰਿਆਨੇ ਦੀ ਦੁਕਾਨ ਦਾ ਬਿਜ਼ਨਸ ਅਤੇ ਡੇਅਰੀ ਦਾ ਬਿਜ਼ਨਸ ਅਤੇ ਹੋਰ ਵੀ ਅਧਿਕ ਤਰੀਕੇ ਦੇ ਬਿਜ਼ਨਸ ਚਲਦੇ ਹਨ ਜਿੱਦਾਂ ਕਿ ਸਟੇਸ਼ਨਰੀ ਅਤੇ ਪ੍ਰਿੰਟਿੰਗ ਦਾ ਬਿਜ਼ਨਸ ਵੀ ਇਹਦੇ ਵਿੱਚ ਸ਼ਾਮਿਲ ਹੈ ਜਿਹਦੇ ਕਰਕੇ ਸਾਨੂੰ ਕੋਈ ਵੀ ਸਟੇਸ਼ਨਰੀ ਦਾ ਸਮਾਨ ਕੋਈ ਵੀ ਦੁੱਧ ਜਾਂ ਕੋਈ ਵੀ ਤਰੀਕੇ ਦੇ ਖਾਣ ਪੀਣ ਦਾ ਸਮਾਨ ਦੀ ਸਾਨੂੰ ਆ ਤੰਗੀ ਨਹੀਂ ਹੁੰਦੀ ਇੱਥੋਂ ਤੱਕ ਕਿ ਪ੍ਰਿੰਟਿੰਗ ਦੇ ਵਾਸਤੇ ਵੀ ਸਾਨੂੰ ਕੋਈ ਤੰਗੀ ਨਹੀਂ ਹੁੰਦੀ ਵੱਧ ਤੋਂ ਵੱਧ ਸਾਨੂੰ ਸਾਨੂੰ ਹਰ ਇੱਕ ਮਿਠਾਈ ਦਾ ਵੀ ਬਿਜਨਸ ਇੱਥੇ ਚਲਦਾ ਹੈ ਜਿਹਦੇ ਕਰਕੇ ਸਾਨੂੰ ਕੋਈ ਵੀ ਤਰੀਕੇ ਦੀ ਮਿਠਾਈ ਚਾਹੀਦੀ ਹੋਵੇ ਤਾਂ ਉਹ ਵੀ ਸਾਨੂੰ ਨੇੜੇ ਪਏ ਹੀ ਮਿਲ ਜਾਂਦੀ ਹੈ ਜੇ ਤੁਸੀਂ ਦੂਸਰੇ ਤਰੀਕੇ ਦੀ ਗੱਲ ਕਰ ਕੀਤੀ ਜਾਵੇ ਸਟੇਸ਼ਨਰੀ ਦੇ ਤਰੀਕੇ ਦੀ ਤਾਂ ਜੇ ਅਸੀਂ ਸਟੇਸ਼ਨਰੀ ਦਾ ਸਮਾਨ ਖਰੀਦਣਾ ਹੋਵੇ ਕਾਪੀਆਂ ਪੈਨ ਸਕੈਚ ਹਰ ਇੱਕ ਤਰੀਕੇ ਦੇ ਕਲਰਸ ਹਰ ਇੱਕ ਤਰੀਕੇ ਦਾ ਸਟੇਸ਼ਨਰੀ ਦਾ ਸਮਾਨ ਸਾਨੂੰ ਨੇੜੇ ਪਿਆ ਹੀ ਮਿਲ ਜਾਂਦਾ ਹੈ ਜੇ ਅਸੀਂ ਪ੍ਰਿੰਟਿੰਗ ਦੀ ਗੱਲ ਕਰੀਏ ਪ੍ਰਿੰਟਿੰਗ ਦਾ ਵੀ ਕੰਮ ਬਹੁਤ ਹੀ ਵਧੀਆ ਇੱਥੇ ਚਲਦਾ ਹੈ ਕਿਉਂਕਿ ਉਹ ਇੱਕ ਤਾਂ ਸਸਤਾ ਅਤੇ ਟਿਕਾਊ ਵੀ ਹੁੰਦਾ ਹੈ ਕਿਉਂਕਿ ਇੱਥੇ ਜਿਹੜਾ ਪ੍ਰਿੰਟਿੰਗ ਦੇ ਪੈਸੇ ਹਨ ਉਹ ਦੋ ਤੋਂ ਤਿੰਨ ਰੁਪਏ ਦੇ ਵਿੱਚ ਹੀ ਪ੍ਰਿੰਟਿੰਗ ਇੱਕ ਕਾਪੀ ਦੀ ਹੋ ਜਾਂਦੀ ਹੈ ਅਤੇ ਜੇ ਅਸਾਂ ਦੂਸਰੀ ਕਰਿਆਨੇ ਦੀ ਗੱਲ ਕਰੀਏ ਤਾਂ ਕਰਿਆਨਾ ਵੀ ਸਾਨੂੰ ਟਿਕਾਊ ਅਤੇ ਸਸਤਾ ਮਿਲ ਜਾਂਦਾ ਹੈ ਜਿੱਦਾਂ ਕਿ ਟੋਫੀਆਂ ਅਨਾਜ ਚੌਲ ਹਰ ਇੱਕ ਤਰੀਕੇ ਦੇ ਬਾ ਹਰ ਇੱਕ ਤਰੀਕੇ ਦੇ ਕਰਿਆਨੇ ਦਾ ਸਮਾਨ ਸਾਨੂੰ ਮਸਾਲੇ ਤੱਕ ਵੀ ਸਾਨੂੰ ਸਸਤੇ ਅਤੇ ਟਿਕਾਊ ਮਿਲ ਜਾਂਦੇ ਹਨ